ਜੇਕਰ ਮੈਂ ਆਪਣੇ ਖੇਤਰ ਵਿੱਚ ਜ਼ਮੀਨ ਖਰੀਦਣ ਬਾਰੇ ਸੋਚਾਂ ਜਾਂ ਗੱਲ ਕਰਾਂ ਤਾਂ ਹਾਂ ਕੁਝ ਸਮੱਸਿਆਵਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਜਿਵੇਂ ਸਭ ਤੋਂ ਪਹਿਲਾਂ ਤਾਂ ਜ਼ਮੀਨਾਂ ਹੀ ਬਹੁਤ ਮਹਿੰਗੀਆਂ ਹਨ ਥੋੜ੍ਹੀ ਜਿਹੀ ਜ਼ਮੀਨ ਦਾ ਟੁੱਕੜਾ ਲੈਣ ਵਿੱਚ ਵੀ ਬਹੁਤ ਜ਼ਿਆਦਾ ਪੈਸਾ ਲਗਾਉਣਾ ਪੈ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਜੇਕਰ ਉਸਨੂੰ ਇੱਕ ਰਜਿਸਟਰੀ ਕਰਵਾਉਣੀ ਹੋਵੇ ਤਾਂ ਵੀ ਕਾਨੂੰਨ ਦੇ ਕਚਹਿਰੀਆਂ ਦੇ ਬਹੁਤ ਸਾਰੇ ਚੱਕਰ ਕੱਟਣੇ ਪੈ ਜਾਂਦੇ ਹਨ